ਸੱਤ ਜੂਨ ਉੱਨੀ ਸੌ ਛਿਅੱਤਰ ਤੇਰਾਂ ਨਵੰਬਰ ਅਠਾਰਾਂ ਸੌ ਇਕੱਤੀ ਛੱਬੀ ਜਨਵਰੀ ਉੱਨੀ ਸੌ ਚੁਤਾਲੀ ਇਕੱਤੀ ਦਸੰਬਰ ਦੋ ਹਜ਼ਾਰ ਦੋ ਇੱਕ ਜੂਨ ਉੱਨੀ ਸੌ ਛਿਆਹਠ